ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਮਹੱਤਵਪੂਰਨ ਸਬਕ ਸਿੱਖੇ ਨੇ ਕਿਉਂਕਿ ਅੱਜ ਕੱਲ੍ਹ ਜਿਹੜੇ ਲੋਕ ਨੇ ਬੜੇ ਮਤਲਬੀ ਹੋ ਗਏ ਨੇ ਅਤੇ ਸਾਰੇ ਹੀ ਪੈਸੇ ਦੇ ਪੁੱਤਰ ਨੇ ਅਤੇ ਗੱਲ ਕਰੀਏ ਉਹਨਾਂ ਨੇ ਮੈਨੂੰ ਬੜਾ ਮੇਰੇ ਕਾਫੀ ਮਿੱਤਰ ਨੇ ਅਤੇ ਪਿਛਲੇ ਮਹੀਨੇ ਮੈਂ ਇੱਕ ਮਿੱਤਰ ਨੇ ਮੇਰੇ ਤੋਂ ਪੈਸੇ ਉਧਾਰੇ ਲਏ ਅਤੇ ਉਸ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਨਾ ਦਸ ਦਿਨ ਬਾਅਦ ਤੈਨੂੰ ਪੈਸੇ ਵਾਪਸ ਕਰ ਦੂੰਗਾ ਪਰ ਦਸ ਦਿਨ ਦੀ ਬਜਾਏ ਮਹੀਨਾ ਹੋ ਗਿਆ ਪਰ ਉਸ ਨੇ ਮੈਨੂੰ ਪੈਸੇ ਵਾਪਸ ਨਹੀਂ ਕੀਤੇ ਅਤੇ ਮੈਂ ਬੜਾ ਖੱਜਲ ਖੁਆਰ ਹੋਇਆ